ਕਿਸਨੂੰ ਵੀਰੇ ਵਧੀਆ ਵਧੀਆ ਵਧਾਈਆਂ ਤੁਹਾਨੂੰ ਨਵੇਂ ਘਰ ਦੀਆਂ ਹੁਣ ਤਾਂ ਤੁਸੀਂ ਨੇੜੇ ਹੀ ਆ ਗਏ ਸਾਡੇ ਬਹੁਤ ਵਧੀਆ ਹੋ ਗਿਆ ਹੈ ਨਾ ਅਸੀਂ ਜ਼ਰੂਰ ਆਵਾਂਗੇ ਮਿਲਣ ਤੁਹਾਨੂੰ ਹੋਰ ਦੱਸੋ ਫੋਨ ਕਿਵੇਂ ਲਾਇਆ ਕਿਵੇਂ ਸਕੂਲਾਂ ਬਾਰੇ ਪੁੱਛਣਾ ਸੀ ਹਾਂਜੀ ਮੈਂ ਦੱਸਦੀ ਆਹਾਂ ਤੁਹਾਨੂੰ ਵੀ ਐਵੇਂ ਤਾਂ ਮੁਕਤਸਰ ਦੇ ਸਾਰੇ ਸਕੂਲ ਹੀ ਵਧੀਆ ਹੈਗੇ ਆ ਪਰ ਪਰ ਆਪਾਂ ਜੁਆਕਾਂ ਆਪਾਂ ਨੂੰ ਡੀ ਏ ਵੀ ਵਿੱਚ ਪਾਇਆ ਸੀ ਪਹਿਲਾਂ ਤਾਂ ਅੱਗੇ ਵੀ ਉਹਨਾਂ ਦਾ ਇੰਗਲਿਸ਼ ਬੇਸ ਬਣ ਜਾਏ ਵੀ ਉਦੋਂ ਤਾਂ ਨਹੀਂ ਹੁੰਦੇ ਸੀ ਵੀ ਸਰਕਾਰੀ 'ਚ ਇੰਨਾ ਆਤੇ ਫੇਰ ਤਾਂ ਸ ਸਰਕਾਰੀ 'ਚ ਵਾ ਵਾ ਆਗੀਆ ਚੀਜ਼ਾਂ ਅਤੇ ਫਿਰ ਆਪਾਂ ਦਸਵੀਂ ਤੋਂ ਬਾਅਦ ਦੋਨਾਂ ਨੂੰ ਨਾ ਸਰਕਾਰੀ 'ਚ ਪਾ ਦਿੱਤਾ ਕੁੜੀ ਨੂੰ ਗਵਰਮੈਂਟ ਗਲਜ਼ ਸਕੂਲ 'ਚ ਪਾ ਦਿੱਤਾ ਅਤੇ ਬ ਮੁੰਡੇ ਨੂੰ ਬੋਆਏ 'ਚ ਪਾ ਦਿੱਤਾ ਤੁਸੀਂ ਨਾ ਵੀ ਉਸ ਦਾ ਸਟਾਫ ਬਹੁਤ ਵਧੀਆ ਬਹੁਤ ਵਧੀਆ ਮੈਂ ਜਾਣਦੀ ਹਾਂ ਦੋ ਤਿੰਨ ਟੀਚਰਾਂ ਨੂੰ ਵੀ ਬਹੁਤ ਵਧੀਆ ਪੜਾਉਂਦੇ ਆ ਆਪਾਂ ਤਾਂ ਸਾਇੰਸ 'ਚ ਰੱਖਿਆ ਜਵਾਕਾਂ ਨੂੰ ਵੀ ਮੈਂ ਪੜਿਆ ਵੀ ਉਹਨਾਂ ਨੂੰ ਕਾਫੀ ਪ੍ਰਾਈਸ ਪ੍ਰੁਈਜ਼ ਵੀ ਮਿਲੇ ਹੋਏ ਆ ਟੀਚਰਸ ਨੂੰ ਬਹੁਤ ਵਧੀਆ ਹੈਗੇ ਆ ਪ੍ਰੋਫੈਸ਼ਨਲ ਹੈਗੇ ਆ ਟੀਚਰਸ ਨੋਲੇਜ ਆ ਕਾਫੀ ਉਹਨਾਂ ਨੂੰ ਇੰਨੀ ਮਤਲਬ ਪ੍ਰਾ ਪ੍ਰਾਈਵੇਟ ਸਕੂਲ ਵਾਲੇ ਟੀਚਰਸ ਨੂੰ ਨਹੀਂ ਹੁੰਦੀ ਕਿਓਂ ਸਰਕਾਰੀ 'ਚ ਕਾਫੀ ਪੜ੍ਹਾਈ ਕਰਨੀ ਪੈਂਦੀ ਹੈ ਤਾਂ ਕਰਕੇ ਉਹਨਾਂ ਨੂੰ ਨੌਲੇਜ ਵੀ ਵੱਧ ਹੁੰਦੀ ਆ ਪਹਿਲਾਂ ਜੇ ਤੁਸੀਂ ਪਾਉਣਾ ਤਾਂ ਲਿਟਲ ਸਟਾਰ 'ਚ ਵੀ ਪਾ ਸਕਦੇ ਹੋ ਤਾਂ ਕਿ ਬੱਚੇ ਦਾ ਇੰਗਲਿਸ਼ ਦਾ ਬੇਸ ਪਿਓਰ ਬਣ ਜਾਏ ਵਧੀਆ ਬਣ ਜਾਏ ਫਿਰ ਭਲੇ ਤੁਸੀਂ ਸਰਕਾਰੀ 'ਚ ਪਾ ਦਿਆ ਜੇ ਕਿਉਂਕਿ ਫਿਰ ਕਿਉਂਕਿ ਘੱਟ ਆਪਾਂ ਨੂੰ ਨਾਲੇ ਵਧੀਆ ਸਟਾਫ ਆਪਾਂ ਨੂੰ ਕੀ ਚਾਹੀਦਾ ਔਰ ਨਾਲੇ ਹੁਣ ਤਾਂ ਇੰਗਲਿਸ਼ ਮੀਡੀਅਮ ਵੀ ਆ ਗਏ ਸਰਕਾਰੀ 'ਚ ਹੁਣ ਤਾਂ ਹੁਣ ਤਾਂ ਹੋਰ ਵੀ ਵਧੀਆ ਹੋ ਗਿਆ ਜੁਆਕਾਂ ਨੂੰ ਅਤੇ ਸਰਕਾਰੀ ਹੈਗੇ ਆ ਨ ਨਾਲੇ ਸਰਕਾਰੀ ਸਕੂਲ ਫੀਸਾਂ ਵੀ ਘੱਟ ਉੱਤੋਂ ਫਿਰ ਇੰਗਲਿਸ਼ ਮੀਡੀਅਮ ਵੀ ਹੋ ਗਿਆ ਹੋਰ ਮੇਰੀ ਗੁੜੀਆ ਵੀ ਪੜ੍ਹ ਰਹੀ ਹੈ ਪੜ੍ਹ ਰਹੀ ਹੈ ਹੁਣ ਮਿਲਾਂਗੇ ਮਿਲਾਂਗੇ ਜ਼ਰੂਰ ਅਤੇ ਤੁਸੀਂ ਬਾਕੀ ਗੱਲ ਕਰ ਲਿਆ ਜੀ ਸਾਡੇ ਨਾਲ ਵੀ ਅਸੀਂ ਪੁੱਛ ਲਵਾਂਗੇ ਪ੍ਰਿੰਸੀਪਲ ਨੂੰ ਠੀਕ ਆ ਠੀਕ ਆ ਓਕੇ ਜੀ